ਪਸ਼ੂ ਦੇ ਗਰਭ ਦੌਰਾਨ ਵੀ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਕਿ ਇੱਕ ਪਸ਼ੂ ਬੱਚੇ ਨੂੰ ਜਨਮ ਦੇ ਰਿਹਾ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਧਿਆਨ ਵਾਲੀਆਂ ਗੱਲਾਂ ਰੱਖਣੀਆਂ ਚਾਹੀਦੀਆਂ ਹਨ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਪਸ਼ ਪਸ਼ੂ ਬੱਚੇ ਨੂੰ ਜਨਮ ਦੇ ਰਿਹਾ ਹੈ ਤਾਂ ਉਸਦਾ ਆਲਾ ਦੁਆਲਾ ਸਾਰਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਉਹ ਐਂ ਆ ਮਤਲਬ ਕਿ ਜਿਹੜੀਆਂ ਦਵਾਈਆਂ ਉਹਨੂੰ ਦੇਣੀਆਂ ਹਨ ਜਾਂ ਜਿਹੜੇ ਟੀਕੇ ਉਹਨੂੰ ਲਗਾਉਣੇ ਹਨ ਤਾਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਬਚ ਜਦੋਂ ਪਸ਼ੂ ਬੱਚੇ ਨੂੰ ਜਨਮ ਦੇ ਰਿਹਾ ਹੈ ਤਾਂ ਜਦੋਂ ਉਸ ਨੂੰ ਬੜੇ ਧਿਆਨ ਨਾਲ ਹੌਲੀ ਹੌਲੀ ਬਾਹਰ ਕੱਢਣਾ ਕੱਢ ਕੇ ਹੌਲੀ ਹੌਲੀ ਉਹਨੂੰ ਬਾਹਰ ਕੱਢਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਬੱਚੇ ਦੇ ਜਦੋਂ ਉਹ ਨਿਕਲ ਜਾਂਦਾ ਹੈ ਤਾਂ ਜਿਹੜੀ ਉਹਦੀ ਓਲ ਓਲ ਹੁੰਦੀ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਜੇਰ ਕਹਿੰਦੇ ਹਨ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਪਸ਼ੂ ਉਸ ਜੇਰ ਜਾਂ ਓਲ ਨੂੰ ਆਪਣੇ ਆਪ ਮੂੰਹ ਨਾਲ ਖਾ ਨਾ ਲਵੇ ਓ ਉਹਦਾ ਉਸ ਚੀਜ਼ ਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਪਸ਼ੂ ਜਿਹੜੀ ਉਹ ਓਲ ਹੈ ਉਹਨੂੰ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ ਤਾਂ ਜੋ ਹੌਲੀ ਹੌਲੀ ਬੱਚੇ ਦਾ ਜਨਮ ਹੋ ਸਕੇ ਜਨਮ ਦੇ ਦੌਰਾਨ ਵੀ ਆਪਣੇ ਹੱਥਾਂ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿਸੇ ਮਤਲਬ ਕਿ ਰੋਗਾਣੂ ਰਹਿਤ ਕਰੀਮ ਜਾਂ ਕੋਈ ਪਾਣੀ ਨਾਲ ਸਾਫ ਕਰਕੇ ਆਪਣੇ ਹੱਥਾਂ ਨੂੰ ਉਹਨਾਂ ਦੇ ਉੱਤੇ ਦਸਤਾਨੇ ਪਾ ਕੇ ਫਿਰ ਬੱਚੂ ਦਾ ਬੱਚੇ ਪਸ਼ੂ ਦਾ ਜ ਦੇ ਬੱਚੇ ਦਾ ਜਨਮ ਦਿਵਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਉਹਨੂੰ ਪਸ਼ੂ ਨੂੰ ਜਨਮ ਤੋਂ ਪਹਿਲਾਂ ਉਹਨਾਂ ਨੂੰ ਖਾਣ ਵਾਸਤੇ ਪੁਰਾਣਾ ਗੁੜ ਦੇਣਾ ਚਾਹੀਦਾ ਹੈ ਪੁਰਾਣਾ ਗੁੜ ਗਰਮ ਹੁੰਦਾ ਹੈ ਗਰਮ ਗਰਮ ਚੀਜ਼ਾਂ ਖਾਣ ਦੇ ਨਾਲ ਪਸ਼ੂ ਦੇ ਬੱਚੇ ਦਾ ਜਨਮ ਹੌਲੀ ਹੌਲੀ ਹੋਵੇਗਾ ਫਿਰ ਉਸ ਫਿਰ ਉਹਨੂੰ ਜਿਹੜਾ ਉਹਦਾ ਬੱਚਾ ਹੋ ਜਾਂਦਾ ਹੈ ਉਹਨੂੰ ਉਹ ਉਹ ਉਹ ਉਹਨੂੰ ਵੀ ਚੰਗੇ ਸਾਫ ਸੁਥਰੇ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਬੱਚਾ ਸਾਫ ਸੁਥਰਾ ਰਹੇ ਅਤੇ ਉਹਦੀ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਇਸ ਤੋਂ ਬਾਅਦ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ ਤਾਂ ਪਸ਼ੂ ਨੂੰ ਬੜੇ ਉਹਦੀ ਜਨਮ ਦੇਣ ਵਾਲੀ ਜਗ੍ਹਾ ਨੂੰ ਸਾਫ ਸੁਥਰਾ ਕਰਕੇ ਇੱਕ ਪਾਸੇ ਕਰਕੇ ਪਸ਼ੂ ਨੂੰ ਰੱਖ ਦੇਣਾ ਚਾਹੀਦਾ ਹੈ ਅਤੇ ਜੇ ਕੋਈ ਟੀਕਾ ਜਾਂ ਕੋਈ ਓ ਬਿਮਾਰ ਹੈ ਤਾਂ ਉਸਨੂੰ ਕੋਈ ਟੀਕਾ ਟੂਕਾ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਉਹਦੇ ਬੱਚੇ ਨੂੰ ਧਿਆਨ ਨਾਲ ਇੱਕ ਪਾਸੇ ਕਰਕੇ ਅਤੇ ਫਿਰ ਬਾਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਨਾਲ ਬ ਬੱਚੇ ਦਾ ਜਨਮ ਬਹੁਤ ਸਹੀ ਤਰੀਕੇ ਨਾਲ ਹੋਵੇਗਾ ਅਤੇ ਤੁਸੀਂ ਬਿਮਾਰੀਆਂ ਤੋਂ ਵੀ ਉਹਦਾ ਇਲਾਜ ਹੋ ਸਕੇਗਾ